ਮੈਂ ਪੇਂਟਿੰਗ ਦੀ ਕੋਈ ਰਸਮੀ ਸਿੱਖਿਆ ਨਹੀਂ ਲਈ ਪਰ ਮੈਨੂੰ ਲੱਗਦਾ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਰੁਚੀ ਹੈ ਤਾਂ ਉਹ ਬਿਨਾਂ ਸਿਖਲਾਈ ਦੇ ਵੀ ਚੰਗਾ ਪੇਂਟਰ ਬਣ ਸਕਦਾ ਹੈ ਕਲਾ ਇੱਕ ਹੁਨਰ ਵੀ ਹੋ ਸਕਦੀ ਹੈ ਜੋ ਅਭਿਆਸ ਨਾਲ ਹੋਰ ਸੁੰਦਰ ਬਣ ਸਕਦੀ ਹੈ ਜੇਕਰ ਕੋਈ ਵਿਅਕਤੀ ਨੂੰ ਕੰਮ ਤੌਰ 'ਤੇ ਪੇਂਟਿੰਗ ਕਰਨਾ ਚਾਹੁੰਦਾ ਹੈ ਤਾਂ ਸਿਖਲਾਈ ਲੈਣੀ ਇੱਕ ਵਧੀਆ ਚੋਣ ਹੋ ਸਕਦੀ ਹੈ ਸਿੱਖਿਆ ਨਾਲ ਕਿਸੇ ਵਿਅਕਤੀ ਨੂੰ ਰੰਗਾਂ ਦੀ ਜਾਣਕਾਰੀ ਚਿੱਤਰਕਾਰੀ ਦੀਆਂ ਤਕਨੀਕਾਂ ਬਾਰੇ ਗਿਆਨ ਮਿਲ ਸਕਦਾ ਹੈ ਪਰ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਕਲਾਕਾਰ ਵਿੱਚ ਜਨੂੰਨ ਅਤੇ ਲਗਨ ਹੋਣੀ ਚਾਹੀਦੀ ਹੈ ਜੇਕਰ ਕਿਸੇ ਪੇਂਟ ਨੂੰ ਪੇਂਟਿੰਗ ਕਰਨਾ ਪਸੰਦ ਹੈ ਤਾਂ ਉਹ ਆਪਣੇ ਤਰੀਕੇ ਨਾਲ ਜਾਂ ਕਿਸੇ ਵੀ ਤਰੀਕੇ ਨਾਲ ਇਹ ਕੰਮ ਕਰ ਸਕਦਾ ਹੈ ਅਤੇ ਅੱਗੇ ਵੱਧ ਸਕਦਾ ਹੈ ਧੰਨਵਾਦ